ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਲ ਹੈ ਕਿ ਪੰਜਾਬ ਵਿੱਚ ਕਾਰੋਬਾਰ ਆਪਣੇ ਸੰਚਾਲਿਤ ਅਤੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਟੈਕਨੋਲਜੀ ਅਤੇ ਨਵੀਂਕਰਨ ਦੀ ਵਰਤੋਂ ਕਿਵੇਂ ਕਰਦੇ ਹਨ ਦੁਕਾਨਦਾਰ ਜਾਂ ਕਾਰੋ ਕਾਰੋਬਾਰ ਜਦੋਂ ਦੁਕਾਨਦਾਰ ਆਪਣੀ ਟੈਕਨੋਲਜੀ ਦਾ ਨਵੀਂਕਰਨ ਦੀ ਵਰਤੋਂ ਇਹ ਉਹ ਜਿਵੇਂ ਇੰਟਰਨੈਟ ਦੀਆਂ ਸੁਵਿਧਾਵਾਂ ਨਾਲ ਆਪਣੀ ਕੈਸ਼ ਆ ਜਿਵੇਂ ਡਿਲੀਵਰੀ ਹੋ ਗਿਆ ਆਪਣਾ ਡਿਲੀਵਰੀ ਕਰਨ ਜਾਂਦੇ ਨੇ ਹੈਗੇ ਡਿਲੀਵਰੀ ਰੱਖੇ ਹੋਏ ਆ ਜਾਂ ਫਿਰ ਆਪਣੇ ਵਟਸਐਪ ਜਾਂ ਕਿਸੇ ਵੀ ਹੋਰ ਕਿਸੇ ਵੀ ਜ਼ਰੀਏ ਇੰਟਰਨੈਟ ਦੇ ਜ਼ਰੀਏ ਜੋ ਲੋਕਾਂ ਨੂੰ ਇੰਟਰਨੈਟ ਦੇ ਜਿਹੜੇ ਦਰਸਾਉਂਦੇ ਨੇ ਅਤੇ ਉਹ ਮੋ ਇੰਟਰਨੈਟ ਦੀ ਵਰਤੋਂ ਦੇ ਨਾਲ ਹੀ ਆਪਣੇ ਉਹਦੇ ਵਿੱਚ ਬੁਕਿੰਗ ਕਰਵਾ ਲੈਂਦੇ ਨੇ ਜੋ ਕਿ ਇਹ ਟੈਕਨੋਲਜੀਆਂ ਗਾਹਕ ਨੂੰ ਦਿੰਦੇ ਨੇ ਜੋ ਕਿ ਘਰ ਬੈਠੇ ਬੈਠੇ ਆਪਣਾ ਕਿਸੇ ਵੀ ਤਰ੍ਹਾਂ ਦਾ ਓਡਰ ਹੈ ਜਿਵੇਂ ਕੋਸਮੈਟਿਕ ਦਾ ਲਾ ਲਓਫਾਸਟ ਫੂਡ ਦਾ ਲਓ ਕੁਛ ਵੀ ਹੈ ਉਹ ਮੋਬਾਈਲ ਦੇ ਜ਼ਰੀਏ ਹੀ ਉਹ ਬੁਕਿੰਗ ਹੋ ਜਾਂਦੀ ਹੈ ਅਤੇ ਇਹਦੇ ਬਹੁਤ ਨਵੀਂਕਰਨ ਕੀਤੇ ਨੇ ਜਿਵੇਂ ਲੋਕਾਂ ਨੇ ਬਹੁਤ ਵਧੀਆ ਵਧੀਆ ਰੈਸਟੋਰੈਂਟ ਜਾਂ ਕਿਸੇ ਵੀ ਚੀਜ਼ ਦੀ ਨਵੀਕਰਤਾ ਕੀਤੀ ਹੈ ਜਿਵੇਂ ਨਵਾਂ ਅੱਖਾਂ ਨੂੰ ਦੇਖਣਾ ਸੋਹਣਾ ਲੱਗੇ ਜਾਂ ਕੁਛ ਵੀ ਲਾ ਲਓ ਬਹੁਤ ਹੀ